ਭਾਰਤ ਇੱਕ ਵਿਵਿੱਤਾ ਦਾ ਦੇਸ਼ ਹੈ ਇੱਥੇ ਬਹੁਤ ਜੇ ਵੱਖ ਵੱਖ ਸਥਾਨ ਹਨ ਘੁੰਮਣ ਫਿਰਨ ਲਈ ਅਤੇ ਇੱਥੇ ਲੋਕ ਵੀ ਬਹੁਤ ਵੱਖ ਵੱਖ ਹਨ ਜਿਵੇਂ ਜਿਵੇਂ ਸਟੇਟ ਬਦਲਦੀ ਹੈ ਲੋਕ ਬਦਲਦੇ ਹਨ ਲੋਕਾਂ ਦਾ ਰਹਿਣ ਦਾ ਕਲਚਰ ਬਦਲਦਾ ਹੈ ਅਤੇ ਭਾਰਤ ਵਿੱਚ ਇੱਕ ਥਾਂ ਤੋਂ ਦੂਜੇ ਥਾਂ 'ਤੇ ਪਹੁੰਚਣ ਲਈ ਸਾਨੂੰ ਪ੍ਰਮੁੱਖ ਚੀਜ਼ ਜਿਹਨੂੰ ਮੰਨਿਆ ਜਾਂਦਾ ਹੈ ਉਹ ਹੈ ਟਰੇਨਾਂ ਟਰੇਨਾਂ ਬਹੁਤ ਵਧੀਆ ਸਾਧਨ ਹਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪੁੱਜਣ ਲਈ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਹੀ ਕਮ ਕੀਮਤ ਵਿੱਚ ਆਉਂਦੀਆਂ ਹਨ ਕਿਉਂਕਿ ਇੱਕ ਬੰਦਾ ਬਹੁਤ ਕੰਮ ਕੀਮਤ ਵਿਚ ਟਿਕਟਾਂ ਕਟਾ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਸਕਦਾ ਹੈ ਅਤੇ ਉਹ ਬਹੁਤ ਆਸਾਨੀ ਨਾਲ ਵੀ ਪਹੁੰਚ ਸਕਦਾ ਹੈ ਕਿਉਂਕਿ ਇਸ ਵਿੱਚ ਬਹਿਣ ਲਈ ਬਹੁਤ ਵਧੀਆ ਸੀਟਾਂ ਹੁੰਦੀਆਂ ਹਨ ਸੌਣ ਲਈ ਵੀ ਬਹੁਤ ਵਧੀਆ ਸੀਟਾਂ ਹੁੰਦੀਆਂ ਪਰ ਇਸ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਜਦੋਂ ਤਿਉਹਾਰਾਂ ਦਾ ਦਿਨ ਚੱਲਦਾ ਹੈ ਤਾਂ ਇਸ ਵਿੱਚ ਰਸ਼ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜਿਹਨਾਂ ਦੀਆ ਟਿਕਟਾਂ ਵੀ ਹੁੰਦੀਆਂ ਹਨ ਉਹਨਾਂ ਨੂੰ ਵੀ ਆਪਣੀਆਂ ਸੀਟਾਂ ਨਹੀਂ ਮਿਲ ਪਾਉਂਦੀਆਂ ਹਨ ਜਿਸ ਕਰਕੇ ਬਹੁਤ ਵਾਰ ਬਹੁਤ ਲੋਕ ਬਹੁਤ ਦੁਖੀ ਹੁੰਦੇ ਹਨ ਇਸ ਦਾ ਇੱਕੋ ਹੀ ਉਪਾਅ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੀਆਂ ਸੀਟਾਂ ਹਨ ਉਨੀਆਂ ਹੀ ਟਿਕਟਾਂ ਬੁੱਕ ਕੀਤੀਆਂ ਜਾਣ ਜਾਂ ਤਾਂ ਡੱਬੇ ਹੋਰ ਵਧਾਏ ਜਾ ਸਕਦੇ ਹਨ